ਮੇਰਾ ਨਾਮ ਮਮਤਾ ਦੇਵੀ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਜੇ ਮੈਂ ਗੱਲ ਕਰਾਂ ਕੁਝ ਮਹਾਨ ਆਗੂ ਰਾਜਿਆਂ ਦੇ ਬਾਰੇ ਜਿਹਨਾਂ ਬਾਰੇ ਮੈਂ ਆਪਣੇ ਦਾਦਾ ਪਿਤਾ ਜੀ ਤੋਂ ਸੁਣਿਆ ਹੈ ਉਹਨਾਂ ਨੇ ਸਾਡੇ ਪਠਾਨਕੋਟ ਖੇਤਰ ਦੇ ਇਤਿਹਾਸ ਵਿੱਚ ਕਿਵੇਂ ਯੋਗਦਾਨ ਪਾਇਆ ਉਹ ਇਸ ਤਰ੍ਹਾਂ ਅ ਪਠਾਨਕੋਟ ਦੇ ਇਤਿਹਾਸ ਵਿੱਚ ਕੁਝ ਮਹਾਨ ਆਗੂ ਅਤੇ ਰਾਜੇ ਹਨ ਜਿਹਨਾਂ ਨੇ ਪਠਾਨਕੋਟ ਲਈ ਬਹੁਤ ਕੁਝ ਕੀਤਾ ਸੀ ਪਠਾਨਕੋਟ ਦਾ ਇਤਿਹਾਸ ਬਹੁਤ ਵੱਡਾ ਹੈ ਇਹਨਾਂ ਨੂੰ ਮਹਾਨ ਆਗੂਆਂ ਅਤੇ ਰਾਜਿਆਂ ਨੇ ਆਪਣਾ ਯੋਗਦਾਨ ਨਾਲ ਵਧਾਇਆ ਉਹਨਾਂ ਦੀਆਂ ਕੁਝ ਮਹੱਤਵਪੂਰਨ ਯੋਗਦਾਨਾਂ ਵਿੱਚ ਸੈਨਾ ਦਾ ਸਾਂਝਾ ਅਤੇ ਅਧਿਕਾਰੀਆਂ ਦੀ ਮਦਦ ਦ ਨਾਲ ਮਹਾਨ ਸਮਰਥ ਪੰਜਾਬੀ ਰਾਜਾ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਅਤੇ ਸਹਾਇਤਾ 'ਤੇ ਉਹਨਾਂ ਨੇ ਪਠਾਨਕੋਟ ਦੀ ਰਾਜਧਾਨੀ ਨੂੰ ਮਜਬੂਤ ਕੀਤਾ ਅਤੇ ਇਸ ਨੂੰ ਇੱਕ ਵਧੀਆ ਸ਼ਹਿਰ ਬਣਾਉਣ ਵਿੱਚ ਮਦਦ ਦਿੱਤੀ ਉਹਨਾਂ ਨੇ ਰਾਜਧਾਨੀ ਨੂੰ ਇੱਕ ਮੁੱਖ ਬਾਣੀ ਬਣਾਉਣ ਲਈ ਕਦੇ ਨਾ ਨਹੀਂ ਕੀਤੀ ਅਤੇ ਪੰਜਾਬੀ ਸੱਭਿਆਚਾਰ ਵਾਤਾਵਰਨ ਨੂੰ ਤਰੱਕੀ ਵਿੱਚ ਇਸ ਤੋਂ ਬਾਅਦ ਪਠਾਨਕੋਟ ਸੰਗੀਤ ਕਲਾ ਅਤੇ ਸਾਹਿਤ ਦਾ ਗਰਮ ਕੇਂਦਰ ਬਣਾਇਆ ਪਠਾਨਕੋਟ ਦੇ ਮਹਾਨ ਆਗੂ ਅਤੇ ਰਾਜਾ ਇਸ ਖੇਤਰ ਦੀ ਰਾਜਧਾਨੀ ਨੂੰ ਇੱਕ ਸੈਨਿਕ ਅਤੇ ਇੱਕ ਸ਼ਾਸਕ ਟਿਕਾਣਾ ਬਣਾਇਆ ਬਣਾਉਣ ਵਿੱਚ ਕੁਝ ਮਹੱਤਵਪੂਰਨ ਭੂਮਿਕਾ ਨਿਭਾਈ